ਹਾਂ ਸਾਡੇ ਸਥਾਨ ਦੇ ਅੰਦਰ ਜਾਂ ਨੇੜੇ ਸੈਰ ਸਪਾਟੇ ਦੀਆਂ ਬਹੁਤ ਸਾਰੀਆਂ ਜਗ੍ਹਾ ਬਣਾਈਆਂ ਗਈਆਂ ਹਨ ਕੰਪਨੀ ਬਾਗ ਹੈਗਾ ਜਿਹਦੇ ਵਿੱਚ ਕੀ ਕਰਦੇ ਆ ਸਾਰੇ ਲੋਕ ਸਵੇਰੇ ਜਲਦੀ ਉੱਠ ਕੇ ਸੈਰ ਵਗੈਰਾ ਕੀਤੀ ਜਾਂਦੀ ਹੈ ਐਕਸਰਸਾਈਜ਼ ਕਰਦੇ ਹਨ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੈ ਜਿਵੇਂ ਕਿ ਆਹ ਸਾਡੇ ਮੇਰੇ ਘਰ ਦੇ ਲਾਗੇ ਹੀ ਭੋਜਨ ਦਾ ਵੀ ਇੱਕ ਮਤਲਬ ਬਹੁਤ ਵਧੀਆ ਰੈਸਟੋਰੈਂਟ ਹੈਗੇ ਆ ਜਿੱਥੇ ਬਹੁਤ ਹੀ ਵਧੀਆ ਤਰ੍ਹਾਂ ਦੇ ਚੀਜ਼ਾਂ ਮਿਲਦੀਆਂ ਹਨ ਬਹੁਤ ਅਲੱਗ ਅਲੱਗ ਤਰ੍ਹਾਂ ਦੀਆਂ ਪੰਜਾਬੀ ਲੋਕਾਂ ਨੂੰ ਜੋ ਚੀਜ਼ ਪਸੰਦ ਹੁੰਦੀ ਹੈ ਸਾਗ ਢੋਡਾ ਇਹ ਸਭ ਚੀਜ਼ਾਂ ਵਗੈਰਾ ਹਾਂ ਮਿਲਦੇ ਹਨ ਕੱਪੜੇ ਕੱਪੜਿਆਂ ਦੀ ਵੀ ਦੁਕਾਨਾਂ ਹੈਗੀਆਂ ਇਹਨਾਂ ਛੋਟੇ ਤੋਂ ਛੋਟੇ ਬੱਚਿਆਂ ਤੋ ਲੈ ਕੇ ਵੱਡੇ ਤੋਂ ਵੱਡੇ ਬੱਚਿਆਂ ਤੱਕ ਦੇ ਵੀ ਲੋਕਾਂ ਨੇ ਕੱਪੜੇ ਹੁੰਦੇ ਹਨ ਬਹੁਤ ਮਤਲਬ ਘਰ ਦੇ ਆਲੇ ਦੁਆਲੇ ਹਰ ਚੀਜ਼ ਹੈਗੀ ਆ ਹੋਸਪੀਟਲ ਵੀ ਹੈਗੇ ਆ ਹਨ ਕੱਪੜੇ ਦੀਆਂ ਦੁਕਾਨਾਂ ਵੀ ਹੈਗੀਆ ਭੋਜਨ ਦੀ ਵੀ ਦੁਕਾਨਾਂ ਹੈਗੀਆਂ ਸਾਨੂੰ ਜੋ ਵੀ ਚੀਜ਼ ਸਾਨੂੰ ਚਾਹੀਦੀ ਹੈ ਸਾਨ ਹਾਂ ਬੁੱਕ ਸ਼ੋਪ ਵਗੈਰਾ ਸਭ ਚੀਜ਼ਾਂ ਸਾਡੇ ਘਰ ਦੇ ਆਲੇ ਦੁਆਲੇ ਹੀ ਹੈਗੀਆਂ ਹਨ ਹਨ ਬਹੁਤ ਸਾਰੀਆਂ ਇੱਦਾਂ ਦੇ ਵਿਸ਼ੇਸ਼ਤਾ ਹਨ ਜਿਵੇਂ ਕਿ ਅ ਅਗਰ ਆਪਾਂ ਕੱਪੜੇ ਲੈਣੇ ਚਾਹੁੰਦੇ ਹਾਂ ਹੈ ਨਾ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਸਹੀ ਰੇਟ 'ਤੇ ਸਹੀ ਕੀ ਪੈਸਿਆਂ ਦੇ ਨਾਲ ਸਾਨੂੰ ਕੀ ਹੋਣ ਕਿ ਸਾਨੂੰ ਹਾਂ ਕੱਪੜੇ ਵਗੈਰਾ ਹਾਂ ਮਿਲ ਜਾਣ ਹੋਰ ਵੀ ਕਈ ਤਰ੍ਹਾਂ ਦੇ ਸਮਾਨ ਹੁੰਦੇ ਹਨ ਜੋ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਘਰ ਦੇ ਆਲੇ ਦੁਆਲੇ ਹੀ ਮਿਲ ਜਾਣ ਉਹ ਸਾਨੂੰ ਸਭ ਕੁਛ ਮਿਲ ਜਾਂਦਾ ਹੈ ਇਹ ਅਤੇ ਹੋਰ ਵੀ ਬਹੁਤ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਹਨ ਜੋ ਜਿਵੇਂ ਕਿ ਸੈਰ ਸਪਾਟੇ ਦੇ ਗਰਾਊਂਡ ਵਗੈਰਾ ਬਣਾਏ ਜਾਂਦੇ ਹਨ ਅਤੇ ਹੋਰ ਵੀ ਬਹੁਤ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜੋ ਸਾਡੇ ਬੱਚਿਆਂ ਨੂੰ ਖੇਡਣ ਦੇ ਗਰਾਊਂਡ ਹੈਗੇ ਹਨ